ਜਿਵੇਂ ਕਿ ਮੈਂ ਘੁੰਮਣ ਦਾ ਬਹੁਤ ਸ਼ੌਕੀਨ ਹਾਂ ਮੈਂ ਹੁਣ ਤੱਕ ਬਹੁਤ ਜਗ੍ਹਾ 'ਤੇ ਘੁੰਮਿਆ ਹੈ ਬਟ ਸਭ ਤੋਂ ਜਿਹੜੀ ਮੇਰੀ ਵਧੀਆ ਯਾਤਰਾ ਸੀ ਜੋ ਕਿ ਬਹੁਤ ਟਫ ਸੀ ਉਹ ਸੀ ਤਰਿਉਂਦ ਦੀ ਜੀ ਇਹ ਯਾਤਰਾ ਮੈਂ ਆਪਣੇ ਦੋਸਤਾਂ ਨਾਲ ਕੀਤੀ ਸੀ ਮੈਂ ਅਸੀਂ ਚਾਰ ਦੋ ਦੋਸਤ ਸੀ 'ਤੇ ਅਸੀਂ ਸ਼ਾਮ ਨੂੰ ਇੱਥੋਂ ਮੋਹਾਲੀ ਤੋਂ ਅਸੀਂ ਬੱਸ 'ਤੇ ਚੜ੍ਹ ਕੇ ਧਰਮਸ਼ਾਲਾ ਲਈ ਗਏ ਸੀ ਫਿਰ ਉਥੋਂ ਅਸੀਂ ਉੱਥੇ ਚਾਰ ਵਜੇ ਪਹੁੰਚ ਗਏ ਸੀ ਜੀ ਚਾਰ ਵਜੇ ਤੋਂ ਬਾਅਦ ਅਸੀਂ ਉੱਥੇ ਵੇਟ ਕੀਤੀ ਸਵੇਰੇ ਬੱਸ ਸਿਗੀ ਜੀ ਛੇ ਵਜੇ ਅਸੀਂ ਦੋ ਘੰਟੇ ਬੱਸ ਸਟ ਸਟੋਪ 'ਤੇ ਵੇਟ ਕੀਤੀ ਰੁਕੇ ਉਹਤੋਂ ਬਾਅਦ ਅਸੀਂ ਜਦੋਂ ਬੱਸ ਆਈ ਬੱਸ 'ਚ ਬੈਠ ਕੇ ਅਸੀਂ ਮਕਲੋੜਗੰਜ ਲਈ ਗਏ ਮਕਲੋੜਗੰਜ ਜਾ ਕੇ ਅਸੀਂ ਉੱਥੇ ਰਹਿਣ ਲਈ ਇੱਕ ਹੋਟਲ ਲੱਭਿਆ ਅਤੇ ਹੋਟਲ ਲੱਭਦੇ ਲੱਭਦੇ ਸਾਨੂੰ ਡੇਢ ਵੱਜ ਗਿਆ ਜੀ ਡੇਢ ਵਜੇ ਤੋਂ ਬਾਅਦ ਅਸੀਂ ਬਹੁਤ ਥੱਕ ਚੁੱਕੇ ਸੀ ਅਸੀਂ ਥੋੜੀ ਰੈਸਟ ਕੀਤੀ ਫਿਰ ਘੁੰਮਣ ਗਏ ਉਹ ਤੋਂ ਬਾਅਦ ਉਹਤੋਂ ਅਗਲੇ ਦਿਨ ਅਸੀਂ ਜਿਹੜੀ ਟਰੈਕਿੰਗ ਕਰਨੀ ਸੀ ਜੀ ਉਹ ਸੀ ਚਾਰ ਘੰਟੇ ਦੀ ਟਰੈਕਿੰਗ ਸੀ ਜੋ ਕਿ ਜਿਹੜਾ ਪਹਾੜ ਸੀ ਉਹ ਬਹੁਤ ਜ਼ਿਆਦਾ ਸਿੱਧਾ ਪਹਾੜ ਸੀ ਜੀ ਅਤੇ ਉੱਥੇ ਕਾਫ਼ੀ ਜ਼ਿਆਦਾ ਪੌੜੀਆਂ ਸੀਗੀਆਂ ਅਤੇ ਉਹ ਅਸੀਂ ਸਵੇਰੇ ਨੌਂ ਵਜੇ ਸਟਾਰਟ ਕੀਤੀ ਸੀ ਜੀ ਸ਼ੁਰੂ ਕਰੀ ਸੀ ਯਾਤਰਾ ਅਤੇ ਸਾਨੂੰ ਉੱਥੇ ਪਹੁੰਚਦੇ ਤੱਕ ਸਾਨੂੰ ਇੱਕ ਡੇਢ ਵੱਜ ਚੁੱਕਿਆ ਸੀ ਜਿਸ ਵਿੱਚ ਅਸੀਂ ਕਾਫ਼ੀ ਜ਼ਿਆਦਾ ਥੱਕ ਚੁੱਕੇ ਸੀ ਰਸਤੇ 'ਚ ਅਸੀਂ ਬਹੁਤ ਜ਼ਿਆਦਾ ਰੁਕ ਰੁਕ ਕੇ ਸਾਨੂੰ ਚੱਲਣਾ ਪਿਆ ਕਿਉਂਕਿ ਜਿਹੜੇ ਮੇਰੇ ਦੋ ਦੋਸਤ ਸੀ ਉਹ ਥੋੜੇ ਜਿਹੇ ਮੋਟੇ ਹਨ ਅਤੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਸੀ ਜੀ ਚੱਲਣ ਲੱਗੇ ਅਤੇ ਅਸੀਂ ਜਿਵੇਂ ਦੋ ਵਜੇ ਉੱਥੇ ਪਹੁੰਚ ਗਏ ਸੀ ਉੱਥੇ ਜਾ ਕੇ ਅਸੀਂ ਇੱਕ ਟੈਂਟ ਲਿਆ ਉੱਥੇ ਦਾ ਜਿਹੜਾ ਦ੍ਰਿਸ਼ ਸੀ ਜੀ ਬਹੁਤ ਸੋਹਣਾ ਸੀ ਪੂਰਾ ਸ਼ਹਿਰ ਜਿਹੜਾ ਉਥੋਂ ਦਿਖ ਰਿਹਾ ਸੀ ਜੀ ਧਰਮਸ਼ਾਲ਼ਾ ਅਤੇ ਮਕਲੋੜਗੰਜ ਦੇ ਥੋੜੇ ਬਹੁਤੇ ਘਰ ਦਿਖਦੇ ਸੀ ਅਤੇ ਉੱਥੇ ਅਸੀਂ ਇੱਕ ਟੈਂਟ ਲੈ ਲਿਆ ਟੈਂਟ ਵਿੱਚ ਅਸੀਂ ਸਾਰੇ ਦੋਸਤਾਂ ਨੇ ਉਹਦੇ ਵਿੱਚ ਬੈਗ ਸਲੀਪਿੰਗ ਬੈਗ ਲਾ ਕੇ ਉੱਥੇ ਸੋਏ ਅਤੇ ਉਹਤੋਂ ਬਾਅਦ ਅਸੀਂ ਇੱਕ ਰਾਤ ਉੱਥੇ ਸਟੇਅ ਕੀਤਾ ਅਤੇ ਉਸ ਤੋਂ ਅਗਲੇ ਦਿਨ ਸਵੇਰੇ ਜਦ ਅਸੀਂ ਉੱਠੇ ਉਥੋਂ ਸਵੇਰ ਦਾ ਜਿਹੜਾ ਸੂਰਜ ਹੁੰਦਾ ਏ ਬਹੁਤ ਸੋਹਣਾ ਦਿਖ ਰਿਹਾ ਸੀ ਅਤੇ ਬਹੁਤ ਸਾਫ਼ ਮੌਸਮ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਉਚਾਈ 'ਤੇ ਹੈਗਾ ਏ ਉਹ ਪਹਾੜ 'ਤੇ ਫਿਰ ਅਸੀਂ ਥੱਲੇ ਜਾਣ ਦਾ ਪਹਾੜ ਤੋਂ ਉੱਤਰਨ ਦਾ ਡਿਸਾਈਡ ਕੀਤਾ ਫਿਰ ਪਹਾੜ ਤੋਂ ਉੱਤਰੇ ਉਹਦੇ ਵਿੱਚ ਵੀ ਸਾਨੂੰ ਤਿੰਨ ਤੋਂ ਚਾਰ ਘੰਟੇ ਲੱਗ ਗਏ ਲੱਗ ਕੇ ਫਿਰ ਅਸੀਂ ਜਾ ਕੇ ਹੋਟਲ 'ਚ ਰਹੇ ਉਹ ਜਿਹੜਾ ਮੇਰੀ ਯਾਤਰਾ ਸੀ ਜੀ ਬਹੁਤ ਹੁਣ ਤੱਕ ਦੀ ਬਹੁਤ ਜ਼ਿਆਦਾ ਮਤਲਬ ਚੜ੍ਹਾਈ ਵਾਲੀ ਕਠਨਾਈ ਵਾਲੀ ਯਾਤਰਾ ਸੀ ਅਤੇ ਬਹੁਤ ਉਹਦੇ ਵਿੱਚ